ਕਿਸਾਨਾਂ ਦੀ ਖੁਦਕੁਸ਼ੀ ਇੱਕ ਬਹੁਤ ਹੀ ਵੱਡਾ ਮੁੱਦਾ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਨੂੰ ਅਤੇ ਖ਼ਾਸ ਕਰਕੇ ਮੇਰੇ ਖਿੱਤੇ ਦੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਤੰਗੀ ਪਰੇਸ਼ਾਨੀ ਉਹਨਾਂ ਦੇ ਪਰਿਵਾਰਾਂ ਨੂੰ ਇਸ ਤੋਂ ਹੋ ਰਹੀ ਹੈ ਕਿਉਂਕਿ ਕਿਸਾਨ ਕਰਜ਼ਾ ਚੁੱਕ ਕੇ ਆਪਣੀ ਫ਼ਸਲ ਨੂੰ ਪਾਲਦਾ ਹੈ ਪਰ ਉਚਿਤ ਰੇਟ ਉਚਿਤ ਮੁਆਵਜਾ ਉਚਿਤ ਸਮੇਂ 'ਤੇ ਉਸ ਦੀ ਫ਼ਸਲ ਦਾ ਭੁਗਤਾਨ ਨਾ ਹੋਣ ਕਾਰਨ ਉਸ ਨੂੰ ਫਿਰ ਖੁਦਕੁਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੁ ਪਰ ਸਰਕਾਰ ਵੱਲੋਂ ਖੁਦਕੁਸ਼ੀ ਨੂੰ ਰੋਕਣ ਵਾਸਤੇ ਕਈ ਤਰ੍ਹਾਂ ਦੇ ਯਤਨ ਕਈ ਤਰ੍ਹਾਂ ਦੀਆਂ ਸੰਸਥਾਵਾਂ ਬਣਾਈਆਂ ਗਈਆਂ ਹਨ ਅਤੇ ਉਹਨਾਂ ਸੰਸਥਾਵਾਂ ਵੱਲੋਂ ਕਈ ਹੈਲਪਲਾਈਨ ਨੰਬਰ ਵੀ ਆਪਣੇ ਅੱਗੇ ਜਾਰੀ ਕੀਤੇ ਗਏ ਹਨ ਪਰ ਉਹਨਾਂ ਹੈਲਪਲਾਈਨਾਂ ਨੰਬਰਾਂ ਦੀ ਸਲਾਹ ਦਾ ਫਾਇਦਾ ਤਦ ਹੀ ਹੋਵੇਗਾ ਜੇ ਉ ਜਦੋਂ ਉਹ ਸਾਰੇ ਹੀ ਕਿਸਾਨਾਂ ਦੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਣ ਉਹਨਾਂ ਸਲਾਹ ਕੇਂਦਰਾਂ ਦੇ ਨਾਲ ਉਹਨਾਂ ਹੈਲਪਲਾਈਨ ਨੰਬਰਾਂ ਦੀ ਮਦਦ ਨਾਲ ਕਿਸਾਨਾਂ ਦੇ ਪਰਿਵਾਰਾਂ ਲਈ ਉਹਨਾਂ ਦੇ ਬੱਚਿਆਂ ਲਈ ਅੱਗੇ ਆਉਣ ਵਾਲੀਆਂ ਪੀ ਆਉਣ ਵਾਲੀ ਜਨਰੇਸ਼ਨ ਲਈ ਜਾਂ ਖੇਤੀ ਦੇ ਵਿੱਚ ਕੁਛ ਮਦਦ ਕੀਤੀ ਜਾਵੇ ਇਸ ਲ ਤਾਂ ਹੀ ਇਹਨਾਂ ਸਲਾਹ ਕੇਂਦਰਾਂ ਅਤੇ ਹੈਲਪਲਾਈਨ ਨੰਬਰਾਂ ਦਾ ਕੋਈ ਫਾਇਦਾ ਹੈ ਪਰ ਕਿਉਂਕਿ ਇੱਕ ਕਿਸਾਨ ਦੀ ਖੁਦਕੁਸ਼ੀ ਕਰਨ ਤੋਂ ਬਾਅਦ ਉਸ ਪਰ ਦੇ ਪਰਿਵਾਰ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੁੰਦਾ ਇਸ ਲਈ ਉਸ ਦੇ ਪਰਿਵਾਰ ਦਾ ਜੀਣਾ ਬਸਰ ਬਸਰ ਕਰਨਾ ਅਤੇ ਜ਼ਿੰਦਗੀ ਜਿਊਣਾ ਉਸ ਦੀ ਜ਼ਿੰਦਗੀ ਨੂੰ ਗੁਜ਼ਾਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ